ਅੱਜ ਦੀ ਤਕਨੀਕੀ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਤੰਦਰੁਸਤੀ ਸਿਰਫ਼ ਸ਼ਰੀਰਕ ਸਿਹਤ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਇਹ ਆਤਮ ਉਤਸ਼ਾਹ ਜੋਸ਼ ਅਤੇ ਖੁਸ਼ਹਾਲੀ ਨਾਲ਼ ਵੀ ਜੁੜ ਚੁੱਕੀ ਹੈ ਵਿਅਕਤੀ ਹੋਰ ਲੋਕਾਂ ਤੋਂ ਵਧੇਰੇ ਬਣਨ ਅਤੇ ਆਪਣੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਅਲੱਗ ਅਲੱਗ ਤਰੀਕੇ ਅਪਣਾਉਂਦੇ ਹਨ ਭੰਗੜਾ ਐਰੋਬਿਕਸ ਅਤੇ ਫਿੱਟਨੈੱਸ ਇਹਨਾਂ ਦੀ ਆਪਣੀ ਅਲੱਗ ਪਹਿਚਾਣ ਹੈ ਜੋ ਲੋਕਾਂ ਨੂੰ ਸਿਰਫ਼ ਤੰਦਰੁਸਤੀ ਨਹੀਂ ਸਗੋਂ ਉਨ੍ਹਾਂ ਵਿੱਚ ਇੱਕ ਅਲੱਗ ਪਹਿਚਾਣ ਲਈ ਪ੍ਰੇਰਨਾ ਵੀ ਪੈਦਾ ਕਰਦਾ ਹੈ ਭੰਗੜਾ ਪੰਜਾਬ ਦੀ ਰੂਹ ਹੈ ਜੋ ਸਾਨੂੰ ਸਰੀਰ ਅਤੇ ਮਾਨਸਿਕ ਤੰਦਰੁਸਤੀ ਦਿੰਦਾ ਹੈ ਇਸ ਵਿੱਚ ਜੋਸ਼ ਉਤਸਾਹ ਅਤੇ ਉਮੀਦ ਦੀ ਝਲਕ ਹੁੰਦੀ ਹੈ ਜਿਸ ਕਰਕੇ ਇਹ ਸਿਰਫ਼ ਇੱਕ ਨੱਚ ਨਹੀਂ ਸਗੋਂ ਜੀਵਨ ਨੂੰ ਉਤਸਾਹ ਨਾਲ਼ ਜੀਣ ਦੀ ਇੱਕ ਅਲੱਗ ਵਿਧੀ ਹੈ ਅਸੀਂ ਜਦੋਂ ਢੋਲ ਦੀ ਤਾਂਘ ਅਤੇ ਭੰਗੜਾ ਪਾਉਂਦੇ ਹਾਂ ਤਾਂ ਸਾਡੀ ਉਤਸਾਹਨਾ ਊਰਜਾ ਅਤੇ ਸ਼ਕਤੀ ਵਿੱਚ ਵਾਧੂ ਆ ਜਾਂਦਾ ਹੈ ਇਹ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸਾਡੀ ਆਤਮ ਸ਼ਕਤੀ ਨੂੰ ਵੀ ਉੱਚਾ ਕਰਦੇ ਹਨ ਵਿਦੇਸ਼ਾਂ ਵਿੱਚ ਭੰਗੜਾ ਫਿੱਟਨੈੱਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਹ ਸੱਭਿਆਚਾਰਕ ਪ੍ਰੰਪਰਾਵਾਂ ਅਤੇ ਆਧੁਨਿਕ ਤੰਦਰੁਸਤੀ ਨੂੰ ਜੋੜਣ ਦਾ ਸਭ ਤੋਂ ਵਧੀਆ ਤਰੀਕਾ ਹੈ ਐਰੋਬਿਕਸ ਆਧੁਨਿਕ ਯੁੱਗ ਦੀ ਇੱਕ ਵਿਗਿਆਨਿਕ ਤਰੀਕੇ ਨਾਲ਼ ਤੰਦਰੁਸਤੀ ਦਾ ਅਨੌਖਾ ਰੂਪ ਹੈ ਇਹ ਉੱਚੀ ਊਰਜਾ ਵਾਲੀ ਐਕਸਰਸਾਈਜ ਹੈ ਜੋ ਦਿਲ ਦੀ ਗਤੀ ਨੂੰ ਸੰਤੁਲਿਤ ਰੱਖਦੀ ਹੈ ਲਚਕੀਲਾਪਨ ਵਧਾਉਂਦੀ ਹੈ ਅਤੇ ਸਰੀਰ ਨੂੰ ਆਕਰਸ਼ਕ ਬਣਾਉਂਦੀ ਹੈ ਇਸ ਵਿੱਚ ਮਿਉਜ਼ਿਕ ਅਤੇ ਬੈਲੈਂਸਡ ਮੂਵਮੈਂਟ ਹੁੰਦੇ ਹਨ ਜਿਸ ਕਰਕੇ ਇਹ ਇੱਕ ਮਨੋਰੰਜਕ ਆਸਾਨ ਅਤੇ ਪ੍ਰਾਵਸ਼ਾਲੀ ਤਰੀਕਾ ਬਣ ਚੁੱਕਾ ਹੈ ਭੰਗੜਾ ਅਤੇ ਐਰੋਬਿਕਸ ਮਿਲ਼ ਕੇ ਭੰਗੜਾ ਐਰੋਬਿਕਸ ਵਰਗੇ ਨਵੇਂ ਟਰੈਂਡ ਪੈਦਾ ਕਰ ਰਹੇ ਹਨ ਫਿੱਟਨੈੱਸ ਇੱਕ ਪੂਰੀ ਜ਼ਿੰਦਗੀ ਦਾ ਦ੍ਰਿਸ਼ਟੀਕੋਣ ਹੈ ਜੋ ਸ਼ਰੀਰਕ ਮਾਨਸਿਕ ਅਤੇ ਆਤਮਿਕ ਤੰਦਰੁਸਤੀ ਅਤੇ ਧਿਆਨ ਦਿੰਦਾ ਹੈ ਫਿੱਟਨੈੱਸ ਵਿਅਗਤੀਗਤ ਸਿਰਫ਼ ਤਾਕਤਵਰ ਨਈਂ ਹੁੰਦੇ ਸਗੋਂ ਉਹ ਆਤਮਵਿਸ਼ਵਾਸੀ ਮੋਟੀਵੇਟਡ ਅਤੇ ਹੋਰ ਲੋਕਾਂ ਤੋਂ ਅਲੱਗ ਹੁੰਦੇ ਹਨ ਜਦੋਂ ਇੱਕ ਵਿਅਕਤੀ ਨਿਯਮਿਤ ਤੌਰ 'ਤੇ ਕਸਰਤ ਕਰਦਾ ਹੈ ਤਾਂ ਓਸ ਦੇ ਜੀਵਨ ਵਿੱਚ ਆਨੰਦ ਸੰਤੁਲਨ ਅਤੇ ਵਧੀਆ ਤੰਦਰੁਸਤੀ ਆਉਂਦੀ ਹੈ ਫਿੱਟਨੈੱਸ ਸਾਨੂੰ ਅਨੁਸ਼ਾਸ਼ਨ ਸਿਖਾਉਂਦੀ ਹੈ ਅਤੇ ਸਾਨੂੰ ਕਿਸੇ ਮੰਜ਼ਿਲ ਤੱਕ ਪਹੁੰਚਣ ਲਈ ਤਿਆਰ ਵੀ ਕਰਦੀ ਹੈ ਹੁਣ ਭਾਵੇਂ ਭੰਗੜਾ ਐਰੋਬਿਕਸ ਫਿੱਟਨੈੱਸ ਇਹ ਤਿੰਨੇ ਸਾਡੇ ਜੀਵਨ ਨੂੰ ਬਿਹਤਰ ਬਣਾਉਂਦੇ ਨੇ ਵਧੀਆ ਤਰੀਕੇ ਦੇ ਨਾਲ਼ ਸਾਨੂੰ ਅੱਗੇ ਵੀ ਵਧਾਉਂਦੇ ਨੇ ਇਹ ਸਾਨੂੰ ਨਾ ਸਿਰਫ਼ ਸਾਨੂੰ ਤੰਦਰੁਸਤ ਬਣਾਉਂਦੇ ਹਨ ਸਗੋਂ ਹੋਰ ਲੋਕਾਂ ਤੋਂ ਅਲੱਗ ਵੀ ਬਣਾਉਂਦੇ ਹਨ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲੀ ਉਤਸ਼ਾਹ ਅਤੇ ਤੰਦਰੁਸਤੀ ਚਾਹੁੰਦੇ ਹਾਂ ਤਾਂ ਇਨ੍ਹਾਂ ਨੂੰ ਸਾਰਿਆਂ ਨੂੰ ਅਪਣਾਓ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਹਿੱਸਾ ਬਣਾਓ ਅਤੇ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰੋ